ਮੇਰਾ ਪਸਿੰਦਦਾ ਖੇਡ ਕ੍ਰਿਕਟ ਹੈ ਅਤੇ ਮੈਨੂੰ ਖਿਡਾਰੀ ਪਸਿੰਦਦਾ ਮਹਿੰਦਰ ਸਿੰਘ ਧੋਨੀ ਹੈ ਜੋ ਕਿ ਉਹਨਾਂ ਦੀ ਕਪਤਾਨੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਉਹਨਾਂ ਦਾ ਸ਼ ਐਨ ਸ਼ਾਂਤ ਰਹਿਣਾ ਸ਼ਾ ਐਨ ਸ਼ਾਂਤ ਖੇਡਣਾ ਬੋ ਬਿਨਾਂ ਬੋਲੇ ਐਨ ਐਨ ਜੈਂਟਲਮੈਨ ਦੀ ਤਰ੍ਹਾਂ ਖੇਡਦੇ ਆ ਐਮ ਐੱਸ ਧੋਨੀ ਉਹਨਾਂ ਦੀ ਖੇਡ ਅਤੇ ਛੋਟੇ ਪਲੇਅਰਾਂ ਨੂੰ ਵੀ ਜਿਹੜੇ ਨਵੇਂ ਨਵੇਂ ਆਏ ਹੁੰਦੇ ਉਹਨਾਂ ਨੂੰ ਬਹੁਤ ਸਪੋਰਟ ਕਰਦੇ ਹਨ ਮਹਿੰਦਰ ਸਿੰਘ ਧੋਨੀ ਇਸ ਕਰਕੇ ਮੈਨੂੰ ਬਹੁਤ ਪਸੰਦ ਨੇ ਉਹਨਾਂ ਨੂੰ ਮੈਮ ਮੈਸ ਧੋ ਅ ਐੱਮ ਐੱਸ ਕੂਲ ਵੀ ਕਿਹਾ ਜਾਂਦਾ ਹੈ ਇਸ ਕਰਕੇ ਮੈਨੂੰ ਬਹੁਤ ਪਸੰਦ ਹਨ ਮਹਿੰਦਰ ਉਹਨਾਂ ਦੀ ਕਪਤਾਨੀ ਬਹੁਤ ਵਧੀਆ ਲੱਗਦੀ ਹੈ